ਹਾਂਜੀ ਕੌਣ ਹੈਲੋ ਹਾਂਜੀ ਹਾਂਜੀ ਓਕੇ ਜਿੱਦਾਂ ਕਿ ਹੁਣ ਅੱਜ ਕੱਲ੍ਹ ਸਾਰੇ ਬਾਹਰ ਜਾ ਰਹੇ ਆ ਅਤੇ ਬਿਕੋਜ ਕਿ ਇੱਥੇ ਕੋਈ ਸਟਰਗਲ ਨਹੀਂ ਕਰਨਾ ਚਾਹੁੰਦਾ ਉੱਥੇ ਜਾ ਕੇ ਉਹ ਛੋਟਾ ਜਿਹਾ ਕੰਮ ਮਿਲ ਜਾਵੇ ਤਾਂ ਉਹਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਾਂ ਉਹ ਹੀ ਕੰਮ ਜੇ ਇੱਥੇ ਕਹਿ ਦਿਓ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਤਾਂ ਜੀ ਬਹੁਤ ਛੋਟਾ ਕੰਮ ਆ ਸ਼ਰਮ ਮੰਨਦੇ ਹਾਂ ਨਾ ਅਤੇ ਇੱਕ ਤਾਂ ਉੱਥੋਂ ਲਾਈਫ ਸਟਾਈਲ ਦੇਖ ਕੇ ਵੀ ਜਿੱਦਾਂ ਮਾਹੌਲ ਦੀ ਨੇਚਰ ਵੀ ਵਧੀਆ ਇਹਦੇ ਨਾਲੋਂ ਤਾਂ ਉੱਧਰ ਅਤੇ ਕਾਫੀ ਚੀਜ਼ਾਂ ਜਿੱਦਾਂ ਇੱਥੋਂ ਦੀਆਂ ਅਤੇ ਉੱਥੋਂ ਦੀਆਂ ਬਹੁਤ ਫ਼ਰਕ ਆ ਹਾਂਜੀ ਅ ਹੋਰ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਉਹ ਤਾਂ

ਸਾਡੇ ਵੱਲੋਂ ਗਏ ਆ ਦੋ ਜਣੇ ਉਹ ਹੀ ਆ ਜਿੱਦਾਂ ਕਿ ਰਿਸ਼ਤੇਦਾਰ ਹੀ ਬਹੁਤ ਆ ਉਹ ਹੀ ਲੈ ਜਾਂਦੇ ਆ ਰਿਲੇਟਿਵਸ ਉਹ ਹੀ ਲੈ ਜਾਂਦੇ ਇੱਕ ਦੂਜੇ ਨੂੰ ਜਿੱਦਾਂ ਕਿ ਜੇ ਕਿਸੇ ਨੇ ਮੈਰਿਜ ਕਰਵਾਉਣੀ ਹੋਵੇ ਮੁੰਡਾ ਬਾਹਰ ਆ ਵਿਆਹ ਕਰਾ ਕੇ ਕੁੜੀ ਨੂੰ ਵੀ ਲੈ ਜਾਂਦਾ ਕੁੜੀ ਇੰਨੀ ਹੁਸ਼ਿਆਰ ਹੁੰਦੀ ਚਲੋ ਜੀ ਜਾਣਾ ਮੈਨੂੰ ਮੁੜ ਕੇ ਇੱਧਰ ਆਉਣ ਦਾ ਨਾਮ ਨਹੀਂ ਲੈਂਦੇ ਪੀ ਆਰ ਲੈ ਕੇ ਇੱਦਾਂ ਹੀ ਪੱਕੇ ਰਹਿੰਦੇ ਕਈ ਤਾਂ ਟੂਰਿਸਟ ਦੇ ਹਿਸਾਬ ਨਾਲ ਵੀ ਚਲ ਜਾਂਦੇ ਆ ਅਤੇ ਇੱਕ ਤਰ੍ਹਾਂ ਘੁੰਮਣ ਦੇ ਜਿੱਦਾਂ ਹੁਣ ਘੁੰਮਣ ਜਾਂਦੇ ਆ ਅਤੇ ਉੱਥੇ ਪੀ ਆਰ ਵਗੈਰਾ ਲੈ ਕੇ ਹੀ ਪੱਕੇ ਹੋ ਜਾਂਦੇ ਆ ਤੁਸੀਂ ਕਿੱਥੋਂ ਹਾਂ ਕਈ ਆਏ ਮਤਲਬ ਕਈ ਪਲੱਸ ਟੂ ਤੋਂ ਬਾਅਦ ਹੀ ਸਿੱਧੀ ਆਇਲੇਟਸ ਕਰਨ ਲੱਗ ਪੈਂਦੇ ਆ ਇੰਨੀ ਛੋਟੀ ਛੋਟੀ ਉਮਰਾਂ ਦੇ ਵਿੱਚ ਅਠਾਰਾਂ ਵੀਹ ਸਾਲ ਦੇ ਵਿੱਚ ਚਲ ਜਾਂਦੇ ਆ ਅੱਜ ਕੱਲ੍ਹ ਤਾਂ ਵਾਹਲਾ ਰਿਵਾਜ਼ ਚੱਲਿਆ ਹਾਂ ਤੁਸੀਂ ਕਿੱਥੋਂ ਹੁਣ ਮੈਂ ਇੱਧਰ ਆਪਣੇ ਮੈਂ ਵੀ ਲੋਕਲ ਹੀ ਹਾਂ ਇੱਧਰ ਹੁਸ਼ਿਆਰਪੁਰ ਊਨਾ ਰੋਡ

ਮੇਰਾ ਮਨ ਹੈਗਾ ਹੈਗਾ ਮਨ ਹੈਗਾ ਮੇਰਾ ਵੀ ਜਾਣ ਦਾ ਮਹੀਨੇ ਕੁ ਤੱਕ ਚਲ ਜਾਣਾ ਮੈਂ ਕੁਛ ਕੰਮ ਸਿੱਖ ਕੇ ਜਾਣਾ ਮਤਲਬ ਕਰਦੀ ਪਈ ਹਾਂ ਬਸ ਲੋਨ ਲੋਨ ਦਾ ਕਰਦੀ ਪਈ ਹਾਂ

ਹਾਂਜੀ ਹਾਂਜੀ ਆਹੀ ਬਸ ਸਾਰਾ ਕੁਛ ਹੋ ਗਿਆ ਮੇਕਅਪ ਦਾ ਵੀ ਹੋ ਗਿਆ ਹੇਅਰਜ਼ ਦਾ ਵੀ ਹੋ ਗਿਆ ਸਕਿਨ ਦਾ ਵੀ ਹੋ ਗਿਆ ਨੇਲਜ਼ ਰਹਿ ਗਏ ਬਸ ਅਮੈਰੀਕਾ ਅਮੈਰੀਕਾ

ਤੁਸੀਂ ਕਰਦੇ ਸਾਡੇ ਸਾਰੇ ਰਿਸ਼ਤੇਦਾਰ ਹੀ ਬਾਹਰ ਆ

ਹਾਂਜੀ ਮੈਨੂੰ ਸੱਦੀ ਜਾਂਦੇ ਤੁਹਾਨੂੰ ਮੈਂ ਦੱਸਿਆ ਤਾਂ ਹੈ ਸਾਰੇ ਰਿਸ਼ਤੇਦਾਰ ਹੀ ਇੱਕ ਦੂਜੇ ਨੂੰ ਮਿਲ ਜਾਂਦੇ ਕਈ ਤਾਂ ਉੱਥੇ ਜਾ ਕੇ ਰੁਸ ਰੁਸ ਜਾਂਦੇ ਕਈ ਹੁੰਦੇ ਚੰਗੇ ਬਿਚਾਰੇ ਤੁਸੀਂ ਕੀ ਕਰਦੇ ਅੱਛਾ ਅੱਛਾ ਕਿੱਥੇ ਕਰਦੇ ਬੀਕੌਮ ਕਿੱਥੇ ਕਰਦੇ ਤੁਸੀਂ ਬੀਕੌਮ ਹਾਂਜੀ ਹਾਂਜੀ ਬੇਟਾ ਹੋਰ ਠੀਕ ਹੈ ਓਕੇ